ਭੰਗੜੇ ਵਿੱਚ ਆਮ ਤੌਰ ਤੇ ਖੁੱਲੇ ਡੁੱਲੇ ਕੱਪੜੇ ਹੀ ਪ੍ਰੈਫਰ ਕੀਤੇ ਜਾਂਦੇ ਹਨ ਜ਼ਿਆਦਾਤਰ ਇਹਨਾਂ ਵਿੱਚੋਂ ਕੱਪੜੇ ਚਮਕਦਾਰ ਹੁੰਦੇ ਹਨ ਤਾਂ ਜੋ ਭੰਗੜਾ ਪਾਉਣ ਵਾਲੇ ਇੱਕ ਆਪਣੀ ਵੱਖਰੀ ਪਹਿਚਾਣ ਸ਼ੁਰੂ ਕਰਨ ਸਕਣ ਭੰਗੜੇ ਦੇ ਪਸ਼ ਪ੍ਰਦਰਸ਼ਨ ਲਈ ਆਮ ਤੌਰ 'ਤੇ ਜੋ ਪਹਿਰਾਵਾ ਪਹਿਨਿਆ ਜਾਂਦਾ ਹੈ ਉਹ ਵੱਖ ਵੱਖ ਤਰੀਕੇ ਕਿਸਮਾਂ ਦਾ ਹੁੰਦਾ ਹੈ ਆਮ ਤੌਰ 'ਤੇ ਮਰਦਾਂ ਲਈ ਚੋਕਾ ਜੋ ਇੱਕ ਕਿਸਮ ਦੀ ਲੰਬੀ ਕਮੀਜ਼ ਹੁੰਦੀ ਹੈ ਅਤੇ ਧੋਤੀ ਜਾਂ ਪਜਾਮਾ ਹੁੰਦਾ ਹੈ ਇਸ ਦੇ ਨਾਲ ਨਾਲ ਉਹ ਲੋਕ ਚਮਕਦਾਰ ਰੰਗਾਂ ਦੇ ਦੂਲੇ ਜਾਂ ਸਾਫਾ ਵੀ ਪਹਿਨਦੇ ਹਨ ਸਾਫਾ ਸਿਰ ਤੇ ਬੰਨਿਆ ਜਾਂਦਾ ਹੈ ਗਲਾਂ ਵਿੱਚ ਕੈਂਠੇ ਪਾਏ ਜਾਂਦੇ ਹਨ ਪੰਜਾਬੀ ਗੱਭਰੂਆਂ ਨੇ ਪੈਰਾਂ ਵਿੱਚ ਚਮਕਦਾਰ ਜੁੱਤੀਆਂ ਪਾਈਆਂ ਹੁੰਦੀਆਂ ਹਨ ਤੇ ਹੱਥਾਂ ਵਿੱਚ ਵਧੀਆ ਕੋਕਿਆਂ ਵਾਲੀ ਡਾਂਗ ਫੜੀ ਹੁੰਦੀ ਹੈ ਮਹਿਲਾਵਾਂ ਲਈ ਭੰਗੜੇ ਵਿੱਚ ਕਿਸਮਤ ਦੇ ਤੌਰ 'ਤੇ ਲਹਿਗਾ ਅਤੇ ਚੋਲੀ ਜਾਂ ਸਾਲਵਾ ਅਤੇ ਕਮੀਜ਼ ਪਹਿਣੀ ਜਾਂਦੀ ਹੈ ਇਹ ਪੋਸ਼ਾਕਾਂ ਅਕਸਰ ਰੰਗ ਬਿਰੰਗੀਆਂ ਕੜਾਈ ਵਾਲੀਆਂ ਤੇ ਆਕਰਸ਼ਕ ਫੈਬਰਿਕ ਨਾਲ ਬਣੀਆਂ ਹੁੰਦੀਆਂ ਹਨ ਜੋ ਡਾਂਸ ਦੇ ਸਮੇਂ ਚਮਕਦਾਰ ਨਜ਼ਰ ਆਉਂਦੀਆਂ ਹਨ ਇਹ ਪੁਸ਼ਾਕਾਂ ਡਾਂਸ ਕਰਨ ਵਾਲਿਆਂ ਨੂੰ ਹੋਰ ਆਕਰਸ਼ਕ ਬਣਾਉਂਦੀਆਂ ਹਨ ਕਿਉਂਕਿ ਰੰਗ ਬਰੰਗੀ ਚਮਕ ਭੰਗੜੇ ਦੀ ਪਹਿਰਾਵੇ ਦੇ ਰੰਗ ਬਹੁਤ ਚਿੱਤਰਕਾਰੀ ਅਤੇ ਚਮਕਦਾਰ ਹੁੰਦੇ ਹਨ ਜੋ ਪ੍ਰਦਰਸ਼ਨ ਨੂੰ ਆਪਣਾ ਕੇਂਦਰ ਬਣਾਉਂਦੇ ਹਨ ਇਹ ਦਿਸ਼ਾ ਵਿੱਚ ਡਾਂਸ ਦੇ ਹਿੱਲ ਦੇ ਹਿੱਸੇ ਨੂੰ ਵਧਾਉਂਦੇ ਹਨ ਜਿਸ ਨਾਲ ਡਾਂਸ ਅਤੇ ਪਹਿਰਾਵੇ ਦੀ ਜੋੜੀ ਵਧੀਆ ਨਿਕਲਦੀ ਹੈ ਵੱਖਰੇ ਤਰ੍ਹਾਂ ਦੇ ਹੈਰਵੇਡੇ ਡਾਂਸ ਦੀ ਗਤੀਸ਼ੀਲਤਾ ਨੂੰ ਜਿਆਦਾ ਪ੍ਰਗਟਾਉਂਦੇ ਹਨ ਜਿਹੇ ਜਿਹੜੇ ਪ੍ਰਦਰਸ਼ਨ ਨੂੰ ਹੋਰ ਮਜੇਦਾਰ ਬਣਾਉਂਦੇ ਹਨ ਇਸ ਤਰ੍ਹਾਂ ਪੁਸ਼ਾਕਾਂ ਦੀ ਚੋਣ ਅਤੇ ਡਿਜ਼ਾਇਨ ਭੰਗੜੇ ਦੇ ਪ੍ਰਦਰਸ਼ਨ ਦੇ ਵਿਸ਼ੇਸ਼ ਆਕਰਸ਼ਕ ਨੂੰ ਉਭਾਰਨ ਵਿੱਚ ਮਦਦ ਕਰਦਾ ਹੈ ਭੰਗੜੇ ਵਿੱਚ ਆਮ ਤੌਰ 'ਤੇ ਖੁੱਲੇ ਡੁੱਲੇ ਕੱਪੜੇ ਹੀ ਪਾਏ ਜਾਂਦੇ ਹਨ ਜਿਸ ਨਾਲ ਭੰਗੜਾ ਪਾਉਣ ਵਾਲੇ ਮੁੰਡੇ ਜਾਂ ਕੁੜੀਆਂ ਕੰਫਰਟੇਬਲ ਫੀਲ ਕਰ ਸਕਣ ਅਤੇ ਵਧੀਆ ਢੰਗ ਨਾਲ ਆਪਣੀ ਪਰਫੋਰਮੈਂਸ ਪੇਸ਼ ਕਰ ਸਕਣ ਭੰਗੜੇ ਵਿੱਚ ਜਿਆਦਾਤਰ ਬੁਕਚੂਆਂ ਦੀ ਜਾਂ ਕਈ ਪੰਜਾਬੀ ਗਹਿਣਿਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕੁੜੀਆਂ ਮੱਥੇ ਤੇ ਟਿੱਕਾ ਲਾਉਂਦੀਆਂ ਹੀ ਲਾਉਂਦੀਆਂ ਹਨ ਤੇ ਪੰਜਾਬੀ ਗੱਭਰੂ ਗਲ ਗਲਾਂ ਵਿੱਚ ਸੋਨੇ ਦਾ ਕੈਂਠਾ ਪਾਉਂਦੇ ਹਨ ਮੌਢਿਆਂ ਤੇ ਵੀ ਤਬੀਤੀਆਂ ਬੰਨੀਆਂ ਹੁੰਦੀਆਂ ਹਨ